ਵਧੀ ਹੋਈ ਪਟਰੋਲ ਦੀ ਕੀਮਤ ਨੇ ਸੱਚਮੁੱਚ ਹੀ ਮੇਰੀ ਬਾਈਕਿੰਗ ਨੂੰ ਪ੍ਰਭਾਵਿਤ ਕੀਤਾ ਕਿਉਂਕਿ ਮੈਂ ਇੱਕ ਨਵੀਂ ਬਾਈਕ ਲਈ ਸੀ ਜਿਸਦੀ ਐਵਰੇਜ ਵੀ ਠੀਕ ਠਾਕ ਸੀ ਪੈਟਰੋਲ ਦੀ ਕੀਮਤ ਵਧੀ ਅਤੇ ਮੈਨੂੰ ਇੱਕ ਤਾਂ ਕੀਮਤ ਬਾਈਕ ਦੀ ਖਰਚਾ ਬਾਈਕ ਦੀ ਜਿਹੜੀ ਕੀਮਤ ਸੀ ਉਸਨੇ ਪ੍ਰਭਾਵਿਤ ਕੀਤਾ ਫਿਰ ਹੁਣ ਪੈਟਰੋਲ ਦੀ ਵੱਧਦੀ ਕੀਮਤ ਨੇ ਪ੍ਰਭਾਵਿਤ ਕੀਤਾ ਅਤੇ ਦੂਜਾ ਜ਼ਿਆਦਾ ਬਾਲਣ ਦੀ ਵਰਤੋਂ ਨਾਲ ਵਾਤਾਵਰਨ ਨੂੰ ਨੁਕਸਾਨ ਹੁੰਦਾ ਹੈ ਕਿਉਂਕਿ ਕਾਰਬਨ ਡਾਈਆਕਸਾਈਡ ਜ਼ਿਆਦਾ ਜਰਨੇਟ ਹੁੰਦੀ ਹੈ ਅੱਜ ਦੇ ਟੈਮ ਦੇ ਵਿੱਚ ਦਰਖ਼ਤ ਬਹੁਤ ਜ਼ਿਆਦਾ ਕੱਟੇ ਜਾ ਰਹੇ ਹਨ ਅਤੇ ਨੁਕਸਾਨ ਵਾਤਾਵਰਨ ਦਾ ਬਹੁਤ ਜ਼ਿਆਦਾ ਹੁੰਦਾ ਇਸ ਨਾਲ ਦਰਖ਼ਤ ਕੱਟਣ ਦੇ ਨਾਲ ਆਕਸੀਜਨ ਦੀ ਮਾਤਰਾ ਘੱਟ ਰਹੀ ਹੈ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਰਹੀ ਹੈ ਇਸ ਕਰਕੇ ਜ਼ਿਆਦਾ ਤੋਂ ਜ਼ਿਆਦਾ ਦਰਖ਼ਤ ਲਗਾਏ ਜਾਣ 'ਤੇ ਬਾਲਣ ਦੀ ਵਰਤੋਂ ਘੱਟ ਕੀਤੀ ਜਾਵੇ